ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ ਸੇਵਾ ਦਾ ਮੌਕਾ ਦਿਓ ਅੱਛਾ ਜੀ ਕਦੋਂ ਦਾ ਫੰਕਸ਼ਨ ਐ ਜੀ ਕਦੋਂ ਦਾ ਫੰਕਸ਼ਨ ਐ ਠੀਕ ਹ ਜੀ ਠੀਕ ਹ ਜੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਵੈਸੇ ਤਾਂ ਗਿਆਰਾਂ ਦਸੰਬਰ ਦਾ ਕਹਿ ਰਹੇ ਹੋ ਤੁਸੀਂ ਵੈਸੇ ਤਾਂ ਭਾਅ ਜੀ ਬਹੁਤ ਲੇਟ ਹੋ ਪਰ ਫਿਰ ਵੀ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਪਰ ਜੇਕਰ ਤਾਂ ਤੁਸੀਂ ਸਾਰੇ ਫੰਕਸ਼ਨਾਂ ਦਾ ਹੀ ਸਾਡੇ ਕੋਲ ਕਰਵਾਉਂਦੇ ਹੋ ਸ਼ੂਟਿੰਗ ਸ਼ੂਟ ਸਾਰਾ ਸਾਡੇ ਕੋਲ ਕਰਾਉਗੇ ਪ੍ਰੀ ਵੈਡਿੰਗ ਦਾ ਜਾਂ ਉਹ ਤਾਂ ਅਸੀਂ ਤੁਹਾਨੂੰ ਕੁਝ ਰਿਆਤ ਵੀ ਕਰਾਂਗੇ ਬਾਕੀ ਤੁਸੀਂ ਆਪਣਾ ਮਨ ਬਣਾ ਲਓ ਹਾਂਜੀ ਚਾਰ ਤੋਂ ਪੰਜ ਲੱਖ ਦਾ ਖਰਚਾ ਆ ਜਾਂਦਾ ਤੇ ਜੇਕਰ ਤੁਸੀਂ ਠੀਕ ਹੈ ਜੀ ਠੀਕ ਹ ਉਹ ਤਾਂ ਜਦੋਂ ਤੁਸੀਂ ਜੇਕਰ ਤੁਸੀਂ ਜਿਹੜਾ ਵੀ ਸਾਨੂੰ ਫੰਕਸ਼ਨ ਤੁਸੀਂ ਸਾਡੀ ਦੁਕਾਨ ਤੇ ਆ ਜਾਓ ਤੁਸੀਂ ਉਹਦੇ ਤੇ ਸਾਨੂੰ ਨੋਟ ਕਰਵਾ ਦਿਓ ਹਲਦੀ ਦਾ ਫੰਕਸ਼ਨ ਪਾਠ ਦਾ ਫੰਕਸ਼ਨ ਹਾਂ ਮਹਿੰਦੀ ਦਾ ਫੰਕਸ਼ਨ ਤੁਸੀਂ ਜਿਹੜਾ ਜਿਹੜਾ ਜਿਵੇਂ ਕਹੋਗੇ ਅਸੀਂ ਸਭ ਚ ਥਾਨੂੰ ਰੈਤ ਦਿਆਂਗੇ ਪਰ ਤੁਸੀਂ ਸਾਡੀ ਫੋਟੋਗ੍ਰਾਫੀ ਦਾ ਵੇਖਿਓ ਜੇ ਤੁਹਾਨੂੰ ਕੋਈ ਵੀ ਐਵੇਂ ਨੀ ਲੱਗੇਗਾ ਕੀ ਇਹ ਇੱਕ ਟਾਈਮ ਪਾਸ ਕੀਤਾ ਹੋਇਆ ਸਾਡੀ ਅਡੀਟਿੰਗ ਸਾਡੀ ਮੇਕਿੰਗ ਅਡੀਟਿੰਗ ਤੁਹਾਨੂੰ ਅਸੀਂ ਆਪਦੀ ਤਰਫੋਂ ਤੇ ਬਹੁਤ ਚੰਗੀ ਦੇਣ ਦੀ ਕੋਸ਼ਿਸ਼ ਕਰਾਂਗੇ ਬੈਸਟ ਤੋਂ ਬੈਸਟ ਹਾਂਜੀ ਹਾਂਜੀ ਥ੍ਰੀ ਐੱਚ ਡੀ ਕੁਆਲਿਟੀ ਹਾਂਜੀ ਉਹ ਤੁਸੀਂ ਬੇਫਿਕਰ ਰਹੋ ਜੀ ਬੇਫਿਕਰ ਰਹੋ ਤੇ ਜਿਹੜੇ ਵੀ ਛੋਟੇ ਛੋਟੇ ਫੰਕਸ਼ਨ ਹੋਣਗੇ ਮੇਨ ਮੇਨ ਇੱਕ ਦੋ ਜਗ੍ਹਾ ਤੇ ਅਸੀਂ ਖੁਦ ਆਵਾਂਗੇ ਬਾਕੀ ਸਾਡੇ ਜਿਹੜੇ ਵਰਕਰ ਨੇ ਉਹ ਵੀ ਬਹੁਤ ਜ਼ਿਆਦਾ ਅੱਛਾ ਕੰਮ ਕਰਦੇ ਨੇ ਸਭ ਨੂੰ ਅੱਛੀਆਂ ਅਸੀ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਨੇ ਉਹ ਉਸ ਦੇ ਨਾਲ ਹੀ ਕੰਮ ਕਰਨਗੇ ਤੇ ਨਾਲ ਤੁਹਾਡੀ ਪੂਰੀ ਮਦਦ ਕਰਨ ਦੇ ਹਰੇਕ ਛੋਟੇ ਛੋਟੇ ਫੰਕਸ਼ਨ ਨੂੰ ਨਿਪਟਾਨ ਵਿੱਚ ਉਵੇਂ ਉਵੇਂ ਤੁਸੀਂ ਫੋਲੋ ਕਰਦੇ ਜਾਇਓ ਜੀ ਤੇ ਤੁਹਾਨੂੰ ਬੜੀ ਇੱਕ ਅੱਛੀ ਵੀਡੀਓ ਤਿਆਰ ਕਰਕੇ ਦਿਆਂਗੇ ਸਾਰੇ ਜਰੂਰ ਜੀ ਜਰੂਰ ਸਭ ਕੁਝ ਮਿਲ ਜਾਏਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਹਲਦੀ ਤੇ ਮਹਿੰਦੀ ਦੇ ਸੈਟ ਅਪ ਵੀ ਚਾਹੀਦਾ ਤੁਹਾਨੂੰ ਤੇ ਸਾਡੇ ਕੋਲ ਆਉਂਦੇ ਵੀ ਵਿਵਸਥਾ ਹੈਗੀ ਹ ਫੁੱਲਾਂ ਵਾਲੇ ਨਾਲ ਵੀ ਸਾਡਾ ਪੂਰਾ ਕੋਟੈਕਟ ਹਾਂਜੀ ਹਾਂਜੀ ਪੂਰਾ ਸੈਟ ਅਪ ਅਸੀਂ ਤਿਆਰ ਕਰਵਾ ਕੇ ਹੀ ਦੇ ਦਿੰਦੇ ਆਂ ਉਹ ਉਹਦੇ ਨਾਲ ਵੀ ਤੁਹਾਨੂੰ ਉਹਦੇ ਚ ਬੜੀ ਰਿਆਇਤ ਮਿਲ ਜਾਏਗੀ ਡਿਸਕਾਊਂਟ ਕਰਨ ਡਿਸਕਾਊਂਟ ਹੀ ਹੋ ਜਾਏਗਾ ਕਾਫੀ ਅੱਛਾ ਜਰੂਰ ਜੀ ਜਰੂਰ ਬੇਫਿਕਰ ਰਹੋ ਜੀ ਫਿਰ ਤੁਸੀਂ ਜਦੋਂ ਵੀ ਆਓਗੇ ਦੁਕਾਨ ਤੇ ਅਸੀਂ ਥੋੜਾ ਜਿਹਾ ਐਡਵਾਂਸ ਲਵਾਂਗੇ ਕਿਉਂਕੀ ਪੇਮੈਂਟ ਦੀ ਫਿਰ ਸਾਨੂੰ ਇਹ ਬੇਫਿਕਰੀ ਹੋ ਜਾਂਦੀ ਹੈ ਜੇ ਤੁਸੀਂ ਸਮੇਂ ਸਿਰ ਕੋਈ ਹੋਰ ਨਾ ਪਹੁੰਚ ਜੇ ਸਾਡੀ ਜਗ੍ਹਾ ਤੇ ਠੀਕ ਆ ਜੀ ਤੁਸੀਂ ਵੀ ਆ ਜਾਓ ਦੁਕਾਨ ਤੇ ਜਦੋਂ ਮਰਜ਼ੀ ਤੁਸੀਂ ਨੋਟ ਕਰਵਾ ਦੋ ਪਰ ਕੋਸ਼ਿਸ਼ ਕਰਿਆ ਜੇ ਸੱਤ ਤਰੀਕ ਤੱਕ ਤਾਂ ਕਰਵਾਈ ਦਿਆ ਜੇ ਹਾਂਜੀ ਠੀਕ ਹੈ ਜੀ